ਹਾਂਜੀ ਬਹੁਤ ਸਾਰੀਆਂ ਸਿੰਮ ਕੰਪਨੀਆਂ ਹਨ ਜਿਹੜੀਆਂ ਇਸ ਖੇਤਰ ਵਿੱਚ ਜ਼ਿਆਦਾ ਵਰਤੀਆਂ ਜਾਂਦੀਆਂ ਹਨ ਜਿਵੇਂ ਕਿ ਜੀਓ ਹੋ ਗਿਆ ਹੈ ਅਤੇ ਏਅਰਟੈਲ ਹੋ ਗਿਆ ਹੈ ਆਈਡੀਆ ਹੋ ਗਿਆ ਹੈ ਬਟ ਜ਼ਿਆਦਾ ਗੱਲ ਕਰੀਏ ਤਾਂ ਅਸੀਂ ਜੀਓ ਦੀ ਗੱਲ ਕਰਾਂਗੇ ਅਤੇ ਸਾਡੇ ਏਰੀਏ ਦੇ ਵਿੱਚ ਜਿਹੜਾ ਜੀਓ ਨੈਟਵਰਕ ਹੈ ਉਹ ਸਭ ਤੋਂ ਤੇਜ਼ ਹੈ ਜੀਓ ਫਾਈਬਰ ਵੀ ਆ ਗਿਆ ਹੁਣ ਤਾਂ ਸੋ ਇਹ ਸਾਡੇ ਖੇਤਰ ਦਾ ਇੱਕ ਐਸਾ ਨੈਟਵਰਕ ਹੈ ਜੋ ਕਿ ਟੈਲੀਫੋਨ ਸੇਵਾਵਾਂ ਅਤੇ ਇੰਟਰਨੈਟ ਸੇਵਾਵਾਂ ਦੋਨੋਂ ਹੀ ਪ੍ਰਦਾਨ ਕਰਦਾ ਹੈ ਜਿਹਨਾਂ ਕਰਕੇ ਬਹੁਤ ਸਾਰੇ ਲੋਕ ਇਸ ਦਾ ਆਨੰਦ ਮਾਣ ਰਹੇ ਹਨ ਅਤੇ ਅੱਗੇ ਬਹੁਤ ਹੀ ਇਹਦੇ ਵਿੱਚ ਕੰਮ ਕਰ ਰਹੇ ਹਨ ਸੋ ਪਹਿਲਾਂ ਜੇ ਗੱਲ ਕੀਤੀ ਜਾਵੇ ਤਾਂ ਬੀਐਸਐਨਐਲ ਬਹੁਤ ਹੀ ਜ਼ਿਆਦਾ ਡਿਮਾਂਡ ਵਿੱਚ ਸੀਗਾ ਪਰ ਜੇ ਅੱਜ ਦੀ ਗੱਲ ਕਰੀਏ ਤਾਂ ਜੀਓ ਨੇ ਸਾਰੀਆਂ ਚੀਜ਼ਾਂ ਕੰਪਨੀਆਂ ਨੂੰ ਪਿੱਛੇ ਛੱਡ ਕੇ ਇਹਦੇ ਉੱਤੇ ਜ਼ਿਆਦਾ ਨਿਵੇਸ਼ ਕੀਤਾ ਹੈ ਅਤੇ ਜ਼ਿਆਦਾ ਤਰੱਕੀਆਂ ਕਮਾਈਆਂ ਹਨ ਸੋ ਇਸ ਕਰਕੇ ਇਹ ਚੀਜ਼ ਜ਼ਿਆਦਾ ਵਧੀਵੀਂ ਅੱਗੇ ਵੱਧ ਰਹੀ ਹੈ